ਅੱਜ ਦੇ ਸੰਸਾਰ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਨੂੰ ਕਿਹੜੀ ਬਹੁਤ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਇੱਕ ਸਟੂਡੈਂਟ ਨੂੰ ਸਰਕਾਰੀ ਨੌਕਰੀ ਦੇ ਲਈ ਪੰਜਾਬੀ ਭਾਸ਼ਾ ਦੇ ਮਟੀਰੀਅਲ ਇਕੱਠਾ ਕਰਨਾ ਬੜਾ ਔਖਾ ਕੰਮ ਹੈ ਅਤੇ ਉਸਨੂੰ ਦੂਜੀ ਭਾਸ਼ਾਵਾਂ ਜਿਵੇਂ ਅੰਗਰੇਜ਼ੀ ਅਤੇ ਹਿੰਦੀ ਦਾ ਸਹਾਰਾ ਲੈਣਾ ਪੈਂਦਾ ਹੈ ਅਤੇ ਪੰਜਾਬੀ ਦਾ ਪੰਜਾਬੀ ਦਾ ਸੰਸਕਰਨ ਨਾ ਮਿਲਣ ਕਰਕੇ ਇਹਨਾਂ ਭਾਸ਼ਾਵਾਂ ਦਾ ਸਹਾਰਾ ਲੈਣਾ ਪੈਂਦਾ ਹੈ ਅਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ